ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂ ਹਾਂਜੀ ਅੱਜ ਕੱਲ੍ਹ ਉਹਦੀ ਕਿ ਹਾਂਜੀ ਹਾਂਜੀ ਅੱਜ ਕੱਲ੍ਹ ਨਾ ਝੋਨੇ ਦੀ ਕਟਾਈ ਹੋ ਰਹੀ ਆ ਅਤੇ ਹ ਹਾਂਜੀ ਹੁਣ ਬਸ ਉਸ ਤੋਂ ਬਾਅਦ ਕਣਕ ਦੀ ਬਿਜਾਈ ਹੋਊਗੀ ਅਤੇ ਜਿਵੇਂ ਹੁ ਹਾਂਜੀ ਹੁਣ ਜਿਵੇਂ ਆਲੂ ਵਗੈਰਾ ਬੀਜਣਗੇ ਸਬਜ਼ੀਆਂ ਮੇਥੇ ਪਾਲਕ ਹਾਂ ਮੇਥੇ ਪਾਲਕ ਬੀ ਹਾਂਜੀ ਹਾਂਜੀ ਤੁਸੀਂ ਆਓ ਸਾਡੇ ਇੱਥੇ ਤੁਹਾਨੂੰ ਮਿਲਣਗੇ ਬੀਜ ਵਧੀਆ ਬੀਜ ਮਿਲਣਗੇ ਅਤੇ ਹਾਂਜੀ ਮੇਥੇ ਪਾਲਕ ਗੋਭੀ ਵਗੈਰਾ ਬੰਦ ਗੋਭੀ ਫੁਲ ਗੋਭੀ ਮਟਰ ਸਾਰੀਆਂ ਹਾਂਜੀ ਹੁਣ ਬਸ ਇਹ ਸਬਜ਼ੀਆਂ ਚੱਲ ਰਹੀਆਂ ਜਿਵੇਂ ਮਟਰ ਹੋ ਗਏ ਗਾਜਰਾਂ ਹੋ ਗਈਆਂ ਅਤੇ ਆਲੂ ਹੋ ਗਏ ਬੰਦ ਗੋਭੀ ਫੁੱਲ ਗੋਭੀ ਅਤੇ ਹਾਂਜੀ ਹਾਂਜੀ ਹਾਂਜੀ ਕਣਕ ਦਾ ਬੀਜ ਵੀ ਮਿਲ ਜੂਗਾ ਫਿਰ ਲੋਕ ਹੁਣ ਉਹਦੇ ਵਿੱਚ ਸਰ੍ਹੋਂ ਜਿਵੇਂ ਸੁੱਟੀ ਜਾਂਦੇ ਆ ਹਾਂਜੀ ਸਰ੍ਹੋਂ ਦੀ ਬਿਜਾਈ ਵੀ ਹੋ ਰਹੀ ਆ ਹੈ ਨਾ ਅਤੇ ਹਾਂਜੀ ਸਾਗ ਵਗੈਰਾ ਜਾਣੀ ਕਿ ਕਈ ਲੋਕ ਵੈਸੇ ਵੀ ਸਰ੍ਹੋਂ ਬੀਜਦੇ ਆ ਸੇਲ ਕਰਨ ਲਈ ਤੇਲ ਵਗੈਰਾ ਬਣਦਾ ਹਾਂਜੀ ਤੇਲ ਹਾਂਜੀ ਤੇਲ ਬਣਾਉਂਦੇ ਆ ਫੇਰ ਹੁਣ ਜਿਵੇਂ ਗ ਗੇਂਦੇ ਦੇ ਫੁੱਲ ਹੁੰਦੇ ਆ ਉਹ ਲਗਾਉਂਦੇ ਆ ਉਹਨਾਂ ਦਾ ਵੀ ਤੇਲ ਬਹੁਤ ਮਹਿੰਗਾ ਵਿਕਦਾ ਬਹੁਤ ਲੋਕ ਵਰਤਦੇ ਆ ਨਾ ਹਾਂਜੀ ਸੂਰਜਮੁਖੀ ਹਾਂਜੀ ਸੂਰਜਮੁਖੀ ਦਾ ਹਾਂਜੀ ਹਾਂਜੀ ਸੂਰਜਮੁਖੀ ਦਾ ਉਹ ਵੀ ਬਹੁਤ ਚੱਲੀ ਜਾਂਦਾ ਅਤੇ ਉੱਥੇ ਲੋਕ ਸਬਜ਼ੀ ਵਗੈਰਾ ਉਹਦੇ 'ਚ ਬਹੁਤ ਯੂਜ ਕਰਦੇ ਆ ਬਣਾਉਣ ਵਿੱਚ ਉਹ ਵੀ ਲਾਉਂਦੇ ਆ ਉਹਦੀ ਹਾਂਜੀ ਉਹਦੀ ਸੇਲ ਵੀ ਚੰਗੀ ਆ ਸੂਰਜਮੁਖੀ ਦੀ ਹਾਂਜੀ ਉਹਦੀ ਸੇਲ ਹਾਂਜੀ ਹਾਂਜੀ ਤੁਸੀਂ ਕਿੰਨਾ ਕੁ ਲੈਣਾ ਬੀਜ ਹਾਂਜੀ ਕੋਈ ਗੱਲ ਨਹੀਂ ਤੁਸੀਂ ਸਾਨੂੰ ਦੱਸ ਦਿਓ ਕਿੰਨਾ ਕੁ ਤੁਹਾਨੂੰ ਚਾਹੀਦਾ ਕੋਈ ਕੋਈ ਗੱਲ ਨਹੀਂ ਤੁਸੀਂ ਸਾਡੇ ਇੱਥੇ ਆਇਓ ਦਫਤਰ ਵਿੱਚ ਅਸੀਂ ਤੁਹਾਨੂੰ ਦੇਵਾਂਗੇ ਬੀਜ ਬਹੁਤ ਲੋਕ ਲੈ ਕੇ ਜਾਂਦੇ ਆ ਬਾਕੀ ਸਾਡੇ ਕੋਲ ਵਧੀਆ ਬੀਜ ਆ ਜਿਹਦੀ ਚੰਗਾ ਝਾੜ ਨਿਕਲਦਾ ਹੈਗਾ ਝਾੜ ਵੀ ਤੁਹਾਡਾ ਵਧੀਆ ਹੋਊਗਾ ਕਣਕ ਦਾ ਹਾਂਜੀ ਚਲੋ ਠੀਕ ਹੈ ਜੀ ਆ ਜਿਓ ਤੁਸੀਂ ਓਕੇ